ਪੰਜਾਬ ਵਿੱਚ ਸਿਹਤ ਸੰਭਾਲ ਟੈਕਨੋਲਜੀ ਦੀ ਵਰਤੋਂ ਵੱਖ ਵੱਖ ਤਰੀਕਿਆਂ ਰਾਹੀਂ ਕੀਤੀ ਜਾ ਰਹੀ ਹੈ ਜਿਵੇਂ ਕਿ ਜਿੰਮ ਦੇ ਵਿੱਚ ਕੀਤੀ ਜਾ ਰਹੀ ਹੈ ਜਿੰਮ ਦੇ ਨਾਲ਼ ਜੋ ਮਤਲਬ ਅੱਜ ਕੱਲ੍ਹ ਦੀ ਯੂਥ ਹੈ ਉਹਨਾਂ ਨੂੰ ਬੋਡੀ ਨੂੰ ਸੰਭਾਲਣ ਦੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਥਰੈਪੀਜ਼ ਮਿਲਦੀਆਂ ਨੇ ਆਪਾਂ ਨੂੰ ਜਿਹਦੇ ਨਾਲ਼ ਸਿਹਤ ਦਾ ਜਿਹੜਾ ਸੰਭਾਲ ਹੁੰਦਾ ਰਹਿੰਦਾ ਹੈ